ਪਿੰਡਾਂ ਅਤੇ ਸ਼ਹਿਰਾਂ ਦੀਆਂ ਖੇਡਾਂ ਵਿੱਚ ਕਾਫ਼ੀ ਅੰਤਰ ਹੈ ਪਿੰਡਾਂ ਵਿੱਚ ਕਾਫ਼ੀ ਧਾਕੜ ਗੇਮਾਂ ਖੇਡੀਆਂ ਜਾਂਦੀਆਂ ਹਨ ਜਿੱਦਾਂ ਕਿ ਕੁਸ਼ਤੀ ਕਬੱਡੀ ਵਰਗੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਸ ਵਿੱਚ ਵ ਵਿਅਕਤੀ ਦੇ ਅੰਦਰ ਦਮ ਹੋਣਾ ਚਾਹੀਦਾ ਹੈ ਜ਼ੋਰ ਹੋਣਾ ਚਾਹੀਦਾ ਹੈ ਬੱਚਿਆਂ ਦੁਆਰਾ ਗੁੱਲੀ ਡੰਡਾ ਵਰਗੀਆਂ ਗੇਮਾਂ ਖੇਡੀਆਂ ਜਾਂਦੀਆਂ ਹਨ ਅਤੇ ਉਹ ਗਲੀਆਂ ਵਿੱਚ ਖੇਡਦੇ ਖੇਡਦੇ ਹਨ ਜਿਸ ਨੂੰ ਉਹ ਬਹੁਤ ਪਸੰਦ ਕਰਦੇ ਹਨ ਸ਼ਹਿਰਾਂ ਦੇ ਵਿੱਚ ਖੇਡਾਂ ਦਾ ਕੁਛ ਅੰਤਰ ਹੈ ਜਿੱਦਾਂ ਸ਼ਹਿਰਾਂ ਦੇ ਵਿੱਚ ਮੋਡਰਨ ਗੇਮਾਂ ਖੇਡੀਆਂ ਜਾਂਦੀਆਂ ਹਨ ਜੋ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਚਲਦੀਆਂ ਹਨ ਜਿੱਦਾਂ ਕਿ ਕ੍ਰਿਕਟ ਬੈਡਮਿੰਟਨ ਵਰਗੀਆਂ ਖੇਡਾਂ ਉਹ ਤਾਂ ਬੱਚੇ ਗਲੀਆਂ ਵਿੱਚ ਵੀ ਖੇਡ ਲੈਂਦੇ ਹਨ ਅਤੇ ਸ਼ਹਿਰਾਂ ਵਿੱਚ ਇਹਨਾਂ ਖੇਡਾਂ ਦੇ ਕੋਂਪਟੀਸ਼ਨ ਵੀ ਹੁੰਦੇ ਹਨ ਜਿਸ ਵਿੱਚ ਲੋਕ ਅ ਬਹੁਤ ਪਾਰਟ ਲੈਂਦੇ ਹਨ ਅਤੇ ਮੈਡਲ ਜਿੱਤ ਕੇ ਲਿਆਉਂਦੇ ਹਨ ਪਿੰਡਾਂ ਦੀਆਂ ਖੇਡਾਂ ਦੇ ਇੰਨੇ ਕੋਂਪਟੀਸ਼ਨ ਨਹੀਂ ਹੁੰਦੇ ਅਗਰ ਹੁੰਦੇ ਵੀ ਹਨ ਤਾਂ ਉਹ ਪਿੰਡਾਂ ਦੇ ਅੰਦਰ ਅੰਦਰ ਹੀ ਰਹਿੰਦੇ ਹਨ ਅਤੇ ਇੰਨੇ ਉੱਚ ਪੱਧਰ 'ਤੇ ਨਹੀਂ ਖੇਡੇ ਜਾਂਦੇ